ਹਾਂਜੀ ਗੁਰਦੀਪ ਸਰ ਬੋਲਦੇ ਮੈਮ ਮੈਂ ਗ੍ਰੈਜੂਏਸ਼ਨ ਕਰੀ ਸੀ ਸਰ ਉਹਦੇ ਬਾਰੇ ਪਤਾ ਕਰਨਾ ਸੀ ਵੀ ਜੋਬ ਕਰਨੀ ਸੀ ਬੀਕੌਮ ਨਹੀਂ ਜੀ ਅੱਛਾ ਜੀ ਠੀਕ ਹੈ ਜੀ ਸਟੈਨੋਂ ਬਾਰੇ ਕੀ ਜਾਣਕਾਰੀ ਹੈ ਜੀ ਉਹ ਵੀ ਸੁਣਿਆ ਬਹੁਤ ਅੱਛਾ ਜੀ ਠੀਕ ਹੈ ਸਰ ਅੱਛਾ ਜੀ ਹਾਂਜੀ ਅੱਛਾ ਜੀ

ਅੱਛਾ ਜੀ ਅੱਛਾ ਜੀ ਠੀਕ ਹੈ ਜੀ ਹਾਂਜੀ ਅੱਛਾ ਜੀ ਠੀਕ ਹੈ ਅੱਛਾ ਜੀ ਇਹਦੀ ਫੀਸ ਕਿੰਨੀ ਕੁ ਹੁੰਦੀ ਹੈ ਸਰ ਠੀਕ ਹੈ ਸਰ ਅੱਛਾ ਅਤੇ ਪੰਜਾਬ 'ਚ ਕਿੰਨਾ ਕੁ ਸਕੋਪ ਹੈ ਜੀ ਇਹਦਾ ਚੱਲੋ ਅਸੀਂ ਤੁਹਾਨੂੰ ਦੱਸ ਦੇਵਾਂਗੇ ਸਰ ਬੈਕ ਕੌਲ ਕਰਕੇ